ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਊਬਰ ਸਰਵਿਸਿਜ਼ ਤੋਂ ਬਲਵਿੰਦਰ ਨਾਲ ਹੋ ਰਹੀ ਹੈ ਜੀ ਭਾਅ ਜੀ ਸ਼ਾਹਪੁਰ ਤੋਂ ਲੈ ਕੇ ਪਠਾਨਕੋਟ ਲਈ ਨਾ ਗੱਡੀ ਕਰਨੀ ਹੈ ਇੱਕ ਤੁਸੀਂ ਸ਼ਾਹਪੁਰ ਦੇ ਹੀ ਹੋ ਜੀ ਹਾਂਜੀ ਅਤੇ ਉੱਧਰ ਮੇਰਾ ਦੋਸਤ ਗਿਆ ਦਾ ਆਪਣੀ ਮਾਤਾ ਜੀ ਨਾਲ ਅਤੇ ਹੁਣ ਉਹਨਾਂ ਨੇ ਪਠਾਨਕੋਟ ਵਾਪਸ ਆਉਣਾ ਹੈ ਜੀ ਉਨ੍ਹਾਂ ਦਾ ਨੰਬਰ ਵਗੈਰਾ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਵਟਸਐਪ 'ਤੇ ਅਤੇ ਤੁਸੀਂ ਚੰਗੀ ਤਰ੍ਹਾਂ ਉਨ੍ਹਾਂ ਨੂੰ ਵਾਪਸ ਛੱਡ ਕੇ ਜਾਣਾ ਪਠਾਨਕੋਟ ਪੈਸੇ ਪੁਸੇ ਤੁਹੀ ਤੁਸੀਂ ਮੈਨੂੰ ਦੱਸ ਦਿਓ ਜੀ ਠੀਕ ਹੈ ਜੀ ਅਤੇ ਉਹ ਤੁਹਾਨੂੰ ਗੂਗਲ ਪੇ ਵਗੈਰਾ ਕਰ ਦਾਂਗਾ ਅਤੇ ਜਿਹੜਾ ਰਸਤੇ 'ਚ ਆਉਂਦਾ ਨਾ ਉਹ ਚੌਂਕ ਜਿਹਾ ਆਉਂਦਾ ਜਿੱਥੇ ਉੱਧਰੋਂ ਕੱਢ ਲਿਓ ਗੱਡੀ ਕਿਹੜਾ ਚੌਂਕ ਹੈ ਉਹ ਭਲਾ ਰਾਮਦੂਤ ਚੌਂਕ ਐਦਾਂ ਕੁਛ ਹੈਗਾ ਚੌਂਕ ਉੱਧਰੋਂ ਕੱਢ ਲਿਓ ਤੁਸੀਂ ਛੇਤੀ ਪੁੱਜ ਜਾਓਂਗੇ ਵੈਹੇ ਤੁਸੀਂ ਡਰੈਵਰ ਹੋ ਤੁਹਾਨੂੰ ਜ਼ਿਆਦਾ ਪਤਾ ਹੋਣਾ ਅਤੇ ਚੰਗੀ ਤਰ੍ਹਾਂ ਉਨ੍ਹਾਂ ਨੂੰ ਧਿਆਨ ਨਾਲ ਪੂਰਾ ਛੱਡ ਕੇ ਆਉਣਾ ਮੈਂ ਤੁਹਾਨੂੰ ਐ ਅਡਰੈਸ ਸੈਂਡ ਕਰ ਦਿੰਨਾ ਕਿੱਥੇ ਛੱਡਣਾ ਪਠਾਨਕੋਟ 'ਚ ਅਤੇ ਠੀਕ ਹੈ ਜੀ ਹੈਤੇ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਸਾਰੀ ਬਹੁਤ ਚੰਗਾ ਦੋਸਤ ਹੈ ਜੀ ਮੇਰਾ ਕੁਛ ਹੋਣਾ ਨਹੀਂ ਚਾਹੀਦਾ ਉਨ੍ਹਾਂ ਨੂੰ ਰਸਤੇ 'ਚ ਚੰਗੀ ਤਰ੍ਹਾਂ ਛੱਡਣਾ ਉੱਥੇ ਉਸੇ ਅਡਰੈਸ 'ਤੇ ਜਿੱਥੇ ਮੈਂ ਤੁਹਾਨੂੰ ਬੋਲਿਆ ਹੈਗਾ ਠੀਕ ਹੈ ਜੀ ਅਤੇ ਰ ਰਸਤਾ ਵਗੈਰਾ ਦੇਖ ਸਭ ਤੋਂ ਛੋਟੇ ਰਸਤੇ ਤੋਂ ਪੁਹੰਚਾਉਣਾ ਜੀ ਉਨ੍ਹਾਂ ਨੂੰ ਕੋਈ ਤਕਲੀਫ ਦੁੱਖ ਕੁਛ ਨਾ ਹੋਵੇ ਚੰਗੀ ਤਰ੍ਹਾਂ ਬਸ ਉਨ੍ਹਾਂ ਨੂੰ ਪਹੁੰਚਾ ਕੇ ਬਸ ਤੁਸੀਂ ਮੇਰੀ ਦੁਆਵਾਂ ਹੀ ਲਓਗੇ ਜੀ ਥੋੜ੍ਹੀ ਮ ਮਾਤਾ ਜੀ ਦੀ ਵੀ ਏਜ ਥੋੜ੍ਹੀ ਜ਼ਿਆਦਾ ਹੀ ਹੈਗੀ ਹੈ ਤਾਂ ਤੁਸੀਂ ਧਿਆਨ ਨਾਲ ਕਰ ਦੋਗੇ ਤਾਂ ਚੰਗਾ ਰਹੇਗਾ ਜੀ ਠੀਕ ਹੈ ਜੀ ਪੈਸੇ ਪੁਸੇ ਮੈਂ ਤੁਹਾਨੂੰ ਭੇਜ ਦਿੰਦਾ ਅਤੇ ਉਨ੍ਹਾਂ ਦਾ ਨੰਬਰ ਤੁਹਾਨੂੰ ਭੇਜ ਦਿੰਦਾ ਠੀਕ ਹੈ ਜੀ ਅਤੇ ਉਨ੍ਹਾਂ ਨਾਲ ਗੱਲ ਕਰ ਲਿਓ ਇੱਕ ਵਾਰ ਅਤੇ ਬਸ ਜੀ ਠੀਕ ਹੈ ਜੀ ਧੰਨਵਾਦ ਜੀ